ਭੰਗੜਾ ਪੰਜਾਬੀਆਂ ਦਾ ਮਨਭਾਉਂਦਾ ਕਲਚਰ ਹੈ ਇਹ ਸਿਰਫ ਪੰਜਾਬ ਵਿੱਚ ਹੀ ਨਹੀਂ ਇਹ ਪੂਰੀ ਦੁਨੀਆਂ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉੱਥੇ ਪ੍ਰਚੱਲਿਤ ਹੈ ਭੰਗੜੇ ਤੋਂ ਬਿਨਾਂ ਕੋਈ ਵੀ ਜਸ਼ਨ ਅਧੂਰਾ ਮੰਨਿਆ ਜਾਂਦਾ ਹੈ ਇਸ ਭੰਗੜਾ ਇੱਕ ਪੰਜਾਬੀਆਂ ਦਾ ਯਹ ਵੀ ਜਿਸ ਨੂੰ ਭੰਗੜਾ ਨਹੀਂ ਆਉਂਦਾ ਉਸ ਨੂੰ ਪੰਜਾਬੀ ਵੀ ਨਹੀਂ ਮ ਮੰਨਦੇ ਇਹ ਪੰਜਾਬੀਆਂ ਦੇ ਖੂਨ ਦਾ ਭੰਗੜੇ ਨਾਲ ਇੱਕ ਰਿਸ਼ਤਾ ਹੈਗਾ ਅਤੇ ਭੰਗੜਾ ਇੱਕ ਪੂਰੇ ਪੂਰੇ ਵਰਡ 'ਚ ਛਾਇਆ ਹੋਇਆ ਪੰਜਾਬੀਆਂ ਦਾ ਭੰਗੜਾ ਢੋਲ 'ਤੇ ਜੋ ਵੱਜਦਾ ਢੋਲ 'ਤੇ ਪੰਜਾਬੀ ਦੇ ਪੈਰ ਆਪੋ ਆਪਣੀ ਥਿਰਕਣ ਲੱਗ ਜਾਂਦੇ ਨੇ ਭੰਗੜੇ ਬਾਰੇ ਬਹੁਤ ਲਿਖਾਰੀ ਨੇ ਬਹੁਤ ਖੂਬ ਬਹੁਤ ਸੋਹਣਾ ਲਿਖਿਆ ਹੈਗਾ ਉਹ ਭੰਗੜਾ ਹਰੇਕ ਭੰਗੜਾ ਡਾਂਸ ਡਾਂਸ ਕਿਸੇ ਵੀ ਵਿਆਹ 'ਚ ਸ਼ਾਦੀ 'ਚ ਜਾਂ ਆਪਣਾ ਹੋਰ ਵੀ ਪ੍ਰੋਗਰਾਮ ਕਰਦੇ ਹਾਂ ਉਸ 'ਤੇ ਭੰਗੜਾ ਇੱਕ ਚਾਰ ਚੰਨ ਲਾ ਦਿੰਦਾ ਅਤੇ ਭੰਗੜਾ ਤਾਂ ਹਰੇਕ ਦੇ ਹੀ ਲਾ ਲਓ ਵੀ ਇੱਕ ਰੂਹ ਦੀ ਖੁਰਾਕ ਹੈ ਜਿਹੜਾ ਬੰਦਾ ਭੰਗੜੇ ਨਾਲ ਇੱਕ ਵਾਰੀ ਅਟੈਚ ਹੋ ਗਿਆ ਜਿਹੜਾ ਵਿਅਕਤੀ ਅਤੇ ਉਸ ਤੋਂ ਭੰਗੜਾ ਸਾਰੀ ਉਮਰ ਭੁੱਲ ਨਹੀਂ ਸਕਦਾ ਹੈਗਾ ਉਹ ਆਪ ਦੇ ਆਪ ਹੀ ਕਿਤੇ ਵੀ ਉਹ ਫੰਕਸ਼ਨ ਹੈ ਉਹ ਭੰਗੜੇ ਨੂੰ ਪਹਿਰ ਪਹਿਲ ਦਿੰਦੇ ਹੈ ਅਤੇ ਬਾਕੀ ਪੰਜਾਬੀਆਂ ਤਾਂ ਵੈਸੇ ਹੀ ਮਨ ਭਾਉਂਦਾ ਇਹ ਪੂਰੀ ਦੁਨੀਆਂ ਵਿੱਚ ਇਸ ਨੂੰ ਸਲਾਹਿਆ ਜਾਂਦਾ ਹੈ ਇਸ ਤੋਂ ਇਲਾਵਾ ਵੀ ਪ ਕੋਈ ਵੀ ਕੋਈ ਫੰਕਸ਼ਨ ਹੁੰਦੇ ਆ ਮੁਕਾਬਲੇ ਹੁੰਦੇ ਆ ਗਿ ਗਿੱਧੇ ਸਿਖਾਏ ਜਾਂਦੇ ਆ ਗਿੱਧੇ ਦੀਆਂ ਸਪੈਸ਼ਲ ਅਕੈਡਮੀਆਂ ਬਣੀਆਂ ਹੋਈਆਂ ਨੇ ਬਾਹਰਲੇ ਦੇਸ਼ਾਂ 'ਚ ਵੀ ਗਿੱਧੇ ਦੇ ਬਕਾਇਦਾ ਕਲੱਬ ਬਣੇ ਹੋਏ ਨੇ ਜੋ ਬੱਚਿਆਂ ਨੂੰ ਭੰਗੜਾ ਸਿਖਾਉਂਦੇ ਨੇ ਅਤੇ ਹੁਣ ਤਾਂ ਬਗੈਰ ਪੰਜਾਬੀਆਂ ਤੋਂ ਬਗੈਰ ਵੀ ਜੋ ਦੂਸਰੇ ਕਰਦੇ ਨੇ ਅੱਗੇ ਗੋਰੇ ਵੀ ਭੰਗੜਾ ਪਾਉਂਦੇ ਨੇ ਅਤੇ ਅਤੇ ਹੋਰ ਸੂਬਿਆਂ 'ਚ ਵੀ ਭੰਗੜਾ ਪ੍ਰਚਲਨ ਹੈ ਅਤੇ ਭੰਗੜਾ ਤਾਂ ਇੱਕ ਪੰਜਾਬ ਦੀ ਇਕੱਲਾ ਨਹੀਂ ਹੈਗਾ ਇਹ ਸਾਰੇ ਦੇਸ਼ ਦਾ ਪੂਰੀ ਦੁਨੀਆਂ ਦਾ ਇੱਕ ਮਨ ਮਨ ਭਾਉਂਦਾ ਕਲਚਰ ਹੈ ਅਤੇ ਇਹ ਹੌਲੀ ਹੌਲੀ ਆਪਣੇ ਪੈਰ ਅਗਾਂਹ ਨੂੰ ਹੋਰ ਫੈਲ ਫੈਲਾ ਰਿਹਾ ਹੈ ਹੌਲੀ ਹੌਲੀ ਪੂਰੀ ਦੁਨੀਆ ਭੰਗੜੇ ਦੀ ਕੈਲ ਕੈਲ ਹੋਜੂਗੀ ਜਾਵੇਗੀ ਇਸ ਨੂੰ ਕੋਈ ਹਲਕੇ 'ਚ ਨਹੀਂ ਰਹਿ ਸਾ ਸਾ ਸਕਦੇ ਇਹ ਬਹੁਤ ਹੀ ਇੱਕ ਰੂਹ ਦੀ ਖੁਰਾਕ ਹੈ ਜਿਸ ਜਿਸ ਨੂੰ ਵੀ ਉਹ ਕਰਨਾ ਭੰਗੜੇ ਭੰਗੜੇ ਬਾਰੇ ਕੋਚਿੰਗ ਲੈਣੀ ਆ ਹਰੇਕ ਥਾਂ ਅਕੈਡਮੀ ਖੁੱਲ੍ਹੀ ਖੁੱਲੀਆਂ ਹੋਈਆਂ ਨੇ ਅਕੈਡਮੀ ਤੋਂ ਇਲਾਵਾ ਸਕੂਲਾਂ 'ਚ ਵੀ ਭੰਗੜੇ ਸਿਖਾਏ ਜਾਂਦੇ ਕਾਲਜਾਂ 'ਚ ਵੀ ਭੰਗੜੇ ਸਿਖਾ ਜਾਂਦੇ ਯੂਨੀਵਰਸਿਟੀ ਦੇ ਤਾਂ ਬਹੁਤ ਅੱਗੇ ਨਿਕਲੇ ਹੋਏ ਨੇ ਅਤੇ ਅੱਜ ਕੱਲ੍ਹ ਪੰਜਾਬੀ ਹਰ ਥਾਂ ਭੰਗੜਾ ਆਪਦਾ ਲੈ ਕੇ ਜਾਂਦੇ ਨੇ ਭੰਗੜਾ ਇੱਕ ਰੂਹ ਦੀ ਖੁਰਾਕ ਸਮਝਦੇ ਨੇ ਆਪਣੀ ਅਤੇ ਭੰਗੜੇ ਤੋਂ ਇਲਾਵਾ ਪੰਜਾਬੀ ਪੰਜਾਬੀ ਕਹਾਉਣ ਦਾ ਹੱਕਦਾਰ ਨਹੀਂ ਹੈ